ਹਾਂਜੀ ਮੈਂ ਨਾ ਪਲੇ ਸਟੋਰ ਤੋਂ ਨਾ ਜਿਹੜੀ ਇੱਕ ਨਵੀਂ ਐਪ ਦੀ ਖੋਜ ਕੀਤੀ ਉਹਦੇ ਨਾਲ ਮੈਂ ਵਾਕਿੰਗ ਕਰਦਾ ਸੀਗਾ ਨਾ ਵੀ ਜਿਵੇਂ ਸੈਰ ਕਰਦਾ ਸੀ ਮੈਂ ਮਿੰਟ ਗਿਨ ਗਿਣਨੇ ਸੀ ਕਿਵੇਂ ਮੈਂ ਕਿੰਨੇ ਸਟੈਪ ਹੋਵੇਗਾ ਵੀ ਕਿੰਨੀ ਮੈਂ ਸਟੈਪ ਕਰ ਲਏ ਹੈ ਨਾ ਵੀ ਵੋਕਿੰਗ ਦੇ ਵਿੱਚ ਤਾਂ ਉਹ ਕੀ ਕਿ ਮੈਂ ਨਵੀਂ ਐਪ ਉੱਥੋਂ ਫਾਇੰਡ ਆਊਟ ਕੀਤੀ ਸਟੈਪਰ ਟਰੈਕਰ 'ਤੇ ਜਦੋਂ ਮੈਂ ਵੋਕਿੰਗ ਕਰਦਾ ਉਹ ਮੈਂ ਸਟੈਪਰ ਟਰੈਕਰ ਨੂੰ ਲਗਾ ਲੈਂਦਾ ਗਾ ਉਹਦੇ ਮੈਨੂੰ ਪਤਾ ਲੱਗਦਾ ਰਹਿੰਦਾ ਕਿ ਮੈਂ ਦੋ ਹਜ਼ਾਰ ਤਿੰਨ ਹਜ਼ਾਰ ਛੇ ਚਾਰ ਹਜ਼ਾਰ ਵੀ ਡੇਲੀ ਦਾ ਜਿਵੇਂ ਮੇਰਾ ਇੱਕ ਉਹ ਆ ਲਾਇਆ ਵਿਆ ਹੈਗਾ ਵੀ ਮੈਂ ਛੇ ਹਜ਼ਾਰ ਸਟੈਪ ਕਰਨੇ ਹੈਗੇ ਤਾਂ ਉਹ ਟਰੈਕਰ ਹੈਗਾ ਜਿਹੜਾ ਮੈਨੂੰ ਦੱਸ ਦਿੰਦਾ ਵੀ ਹੁਣ ਤੇਰੇ ਜਿਹੜੇ ਕੀ ਆ ਛੇ ਹਜ਼ਾਰ ਸਟੈਪ ਹੋ ਗਏ ਅਤੇ ਇਹਦੇ ਨਾਲ ਕੀ ਹੈ ਮੇਰੀ ਸਮੱਸਿਆ ਦਾ ਹੱਲ ਹੋ ਗਿਆ ਕਿ ਮੈਂ ਟਾਈਮ ਦੇਖਦਾ ਉਹ ਕਰ ਦਾ ਨਾ ਹੁਣ ਮੈਂ ਲਗਾਤਾਰ ਆਪਣਾ ਚੱਲਦਾ ਰਹਿੰਦਾ ਜੋ ਟਰੈਕਟਰ ਮੈਨੂੰ ਦਿਸਦਾ ਰਹਿੰਦਾ ਹੈਗਾ ਠੀਕ ਹੈ ਅਤੇ ਇਹਦੇ ਨਾਲ ਜਿਹੜਾ ਕੀ ਆ ਸਕਾਰਾਤਮਕ ਦਾ ਪ੍ਰਭਾਵ ਹੈਗੇ ਜਿਹੜਾ ਮੇਰਾ ਧਿਆਨ ਹੈਗਾ ਸਿੱਧਾ ਹੀ ਮੈਂ ਚੱਲਦਾ ਰਹਿੰਦਾ ਵੀ ਆਪਣਾ ਮੈਂ ਚੱਲੀ ਜਾਵਾਂ ਵੀ ਜਦੋਂ ਛੇ ਹਜ਼ਾਰ ਇਹਦੇ ਸਟੈਪ ਹੋ ਗਏ ਤਾਂ ਇਹ ਐਪ ਮੈਨੂੰ ਆਪਣੇ ਆਪ ਹੀ ਦੱਸ ਦੂਗੀ ਹੈ ਨਾ ਤਾਂ ਇਸ ਐਪ ਨੇ ਮੈਨੂੰ ਬਹੁਤ ਜ਼ਿਆਦਾ ਸੁਖਾਲਾ ਮਹਿਸੂਸ ਕਰਤਾ ਹਾਂਜੀ